ਹਾਈਕ ਕਰਨ ਲਈ ਮੇਰੀ ਸਭ ਤੋਂ ਮਨਪਸੰਦ ਜਗ੍ਹਾ ਹੈ ਡਲਹੌਜੀ ਅਤੇ ਮਨਾਲੀ ਹੈ ਕਿਉਂਕਿ ਜਦੋਂ ਮੈਂ ਆਪਣੇ ਘਰਦਿਆਂ ਨਾਲ ਮਨਾਲੀ ਜਾਂ ਡਲਹੌਜ਼ੀ ਗਿਆ ਸੀ ਅਤੇ ਉਹਨਾਂ ਨੇ ਉੱਥੇ ਆਪਾਂ ਬਹੁਤ ਸਾਰੀਆਂ ਆਪਾਂ ਉੱਥੇ ਜਾ ਕੇ ਬਹੁਤ ਨਜ਼ਾਰੇ ਅਤੇ ਸਕੀਨ ਕੀਤੀ ਅਤੇ ਆਪਾਂ ਉੱਥੇ ਪਹਾੜਾਂ ਜਾਂ ਜੰਗਲਾਂ ਵਿੱਚ ਘੁੰਮੇ ਅਤੇ ਆਪਾਂ ਹੋਰ ਵੀ ਉੱਥੇ ਕਈ ਪੰਛੀ ਵੀ ਦੇਖੇ ਹਨ ਜਿਹੜੇ ਤੁਹਾਨੂੰ ਆਪਾਂ ਅੱਜ ਤੱਕ ਕਦੀ ਨਹੀਂ ਦੇਖੇ ਸਨ ਅਤੇ ਆਪਾਂ ਉੱਥੇ ਜੰਗਲ ਵਿੱਚ ਕੁਝ ਇਹੋ ਜਿਹੇ ਜਾਨਵਰ ਦੇਖੇ ਕਿ ਸਾਨੂੰ ਅੱਜ ਤੱਕ ਪਤਾ ਹੀ ਨਹੀਂ ਸੀ ਇਹ ਜਾਨਵਰ ਵੀ ਹੁੰਦੇ ਹਨ ਅਤੇ ਅਸੀਂ ਉੱਥੇ ਬਹੁਤ ਨਜ਼ਾਰੇ ਕੀਤੇ ਆਪਾਂ ਉੱਥੇ ਦੇ ਸੂਰਜ ਚੜਦਾ ਅਤੇ ਸ ਸੂਰਜ ਡੁੱਬਦਾ ਵੀ ਦੇਖਿਆ ਕਿ ਜੋ ਕਿ ਮੈਨੂੰ ਬਹੁਤ ਹੀ ਵਧੀਆ ਲੱਗਾ ਸੀ ਅਤੇ ਅਸੀਂ ਉੱਥੇ ਬੀਚ ਵਿੱਚ ਗਏ ਅ ਉੱਥੇ ਨਦੀਆਂ 'ਤੇ ਘੁੰਮੇ ਸਭ ਕੁਛ ਕੀਤਾ ਅਤੇ ਆਪਾਂ ਉੱਥੇ ਨਦੀਆਂ ਵਿੱਚ ਤੈਰੇ ਵੀ ਸਨ ਜੋ ਕਿ ਮੈਂ ਆਪਣੇ ਘਰਦਿਆਂ ਨਾਲ ਬਹੁਤ ਨਜ਼ਾਰਾ ਕੀਤਾ ਉੱਥੇ ਤੈਰ ਕੇ ਅਤੇ ਉੱਥੇ ਮੈਂ ਦੇਖਿਆ ਕਿ ਉੱਥੇ ਸਾਰੀ ਬਹੁਤ ਸਾਰੀਆਂ ਸੁੰਦਰ ਮਛਲੀਆਂ ਵੀ ਸਨ ਅਤੇ ਹੋਰ ਉੱਥੇ ਜਾ ਕੇ ਆਪਾਂ ਮੈਂ ਆਪਣੇ ਘਰਦਿਆਂ ਨਾਲ ਇੱਕ ਦਿਨ ਅ ਮਨਾਲੀ ਵੀ ਗਿਆ ਸੀ ਜੋ ਕਿ ਆਪਾਂ ਉੱਥੇ ਇੱਕ ਟਾਇਰ ਵਾਲੀ ਟਰੈਕਿੰਗ ਹੁੰਦੀ ਹੈ ਜਿੱਥੋਂ ਕਿ ਆਪਾਂ ਉੱਤੋਂ ਲੈ ਕੇ ਬਰਫ਼ ਤੋਂ ਲੈ ਕੇ ਥੱਲੇ ਪਹਾੜ ਤੱਕ ਆਉਣਾ ਹੁੰਦਾ ਹੈ ਮੈਂ ਉਹ ਵੀ ਕੀਤੀ ਜੋ ਕਿ ਮੈਨੂੰ ਬਹੁਤ ਵਧੀਆ ਲੱਗੀ ਆਪਾਂ ਉੱਥੇ ਸਕੀਨ ਵੀ ਕੀਤੀ ਸਭ ਕੁਛ ਕੀਤਾ ਫਿਰ ਆਪਾਂ ਉੱਥੇ ਖਾਧਾ ਪੀਤਾ ਸਭ ਕੁਛ ਕੀਤਾ ਨਜ਼ਾਰੇ ਲਿੱਤੇ ਫਿਰ ਆਪਾਂ ਉੱਥੋਂ ਵਧੀਆ ਤੋਂ ਵਧੀਆ ਹੋਟਲ ਵਿੱਚ ਰੁਕੇ ਜੋ ਕਿ ਸਾਨੂੰ ਬਹੁਤ ਚੰਗਾ ਲੱਗਾ ਉਹਨਾਂ ਨੇ ਸਾਨੂੰ ਬਹੁਤ ਆਦਰ ਸਤਿਕਾਰ ਦਿੱਤਾ ਅਤੇ ਅਸੀਂ ਫਿਰ ਬਹੁਤ ਨਜ਼ਾਰੇ ਕੀਤੇ ਅਤੇ ਫਿਰ ਆਪਾਂ ਕੁਝ ਪੰਜ ਛੇ ਦਿਨਾਂ ਬਾਅਦ ਆਪਾਂ ਵਾਪਸ ਆ ਗਏ ਅਤੇ ਆਪਾਂ ਆਪਣੇ ਘਰਦਿਆਂ ਨੂੰ ਆ ਕੇ ਦੱਸਿਆ ਕਿ ਇਹ ਸ ਨ ਇਹ ਨਜ਼ਾਰਾ ਬਹੁਤ ਵਧੀਆ ਸੀ ਆਪਾਂ ਉੱਥੇ ਫੋਟੋਆਂ ਵੀ ਖਿੱਚੀਆਂ ਸਭ ਕੁਛ ਕੀਤਾ ਅਤੇ ਫਿਰ